ਮੈਂ ਆਪਣੀ ਜ਼ਿੰਦਗੀ ਵਿੱਚ ਸਭ ਨਾਲੋਂ ਵੱਧ ਆਪਣੇ ਮਾਂ ਬਾਪ ਦਾ ਕਰਦਾ ਹਾਂ ਉਨ੍ਹਾਂ ਨੇ ਸਾਨੂੰ ਪਾਲਿਆ ਪੜ੍ਹਾਇਆ ਲਿਖਾਇਆ ਉਨ੍ਹਾਂ ਨੇ ਸਾਡੇ ਲਈ ਸਭ ਕੁਛ ਕੀਤਾ ਪਰ ਅੱਜ ਦੀ ਡੇਟ ਵਿੱਚ ਜਿਸ ਹਿਸਾਬ ਨਾਲ ਜੋ ਸਮਾਂ ਚੱਲ ਰਿਹਾ ਹੈ ਉਸ ਵਿੱਚ ਬੱਚੇ ਆਪਣੇ ਮਾਂ ਬਾਪ ਨੂੰ ਨਹੀਂ ਸਿਆਣਦੇ ਉਨ੍ਹਾਂ ਨੂੰ ਕਿਤੇ ਨਾ ਕਿਤੇ ਆਸ਼ਰਮ ਵਿੱਚ ਛੱਡ ਕੇ ਆਉਂਦੇ ਹਨ ਤਾਂ ਕਿ ਉਹ ਉਨ੍ਹਾਂ ਤੋਂ ਖਹਿੜਾ ਛੁਡਾ ਸਕੇ ਪਰ ਮੈਂ ਉਨ੍ਹਾਂ ਵਿੱਚੋਂ ਨਹੀਂ ਹੈ ਕਿਉਂਕਿ ਮਾਂ ਬਾਪ ਹੀ ਸਭ ਨਾਲੋਂ ਉੱਪਰ ਹੈ ਮਾਂ ਬਾਪ ਨੂੰ ਅਸੀਂ ਇੱਕ ਰੱਬ ਦਾ ਦਰਜਾ ਵੀ ਦੇ ਸਕਦੇ ਹਨ ਜੋ ਸਾਡੇ ਜ਼ਿੰਦਗੀ ਨੂੰ ਬਣਾਉਣ ਲਈ ਸਭ ਕੁਛ ਕਰਦੇ ਹਨ ਅਤੇ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਹੇੋ ਜਾਵੇ ਅਤੇ ਖੁਸ਼ੀ ਖੁਸ਼ੀ ਆਪਣੀ ਜ਼ਿੰਦਗੀ ਜਿਊਣ ਸਾਡੀ ਖੁਸ਼ੀ ਵਿੱਚ ਹੀ ਉਨ੍ਹਾਂ ਦੀ ਖੁਸ਼ੀ ਹੈ ਸਾਨੂੰ ਖੁਸ਼ ਦੇਖ ਕੇ ਉਹ ਖੁਸ਼ ਹੁੰਦੇ ਹਨ ਉਨ੍ਹਾਂ ਨੂੰ ਸਾਡੇ ਕੋਈ ਪੈਸੇ ਦਾ ਕੋਈ ਮਤਲਬ ਨਹੀਂ ਹੁੰਦਾ ਉਨ੍ਹਾਂ ਨੂੰ ਇਹੀ ਹੁੰਦਾ ਵੀ ਸਾਡੇ ਬੱਚੇ ਜਿਹੜੇ ਉਹ ਖੁਸ਼ ਰਹਿਣ ਉਨ੍ਹਾਂ ਦੀ ਜਿਹੜੀ ਜ਼ਿੰਦਗੀ ਬਹੁਤ ਵਧੀਆ ਲੰਘੇ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਚੰਗਾ ਉੱਠਣਾ ਬੈਠਣਾ ਹੋਵੇ ਅਤੇ ਲੋਕਾਂ ਦੀ ਸੇਵਾ ਕਰੇ ਇਹੀ ਉਹਨਾਂ ਦਾ ਇੱਕ ਫ਼ਰਜ਼ ਵੀ ਹੈ